ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਜੀ ਹਾਂ ਜਿਵੇਂ ਕਿ ਤੁਸੀਂ ਪ੍ਰਸ਼ਨ ਕੀਤਾ ਹੈ ਕਿ ਤੁਹਾਨੂੰ ਯਾਤਰਾ ਕਰਨਾ ਪਸੰਦ ਹੈ ਹਾਂ ਮੈਨੂੰ ਯਾਤਰਾ ਕਰਨਾ ਬਹੁਤ ਹੀ ਪਸੰਦ ਹੈ ਮੇਰੇ ਹਿਸਾਬ ਨਾਲ ਯਾਤਰਾ ਕਰਨੀ ਇੱਕ ਬਹੁਤ ਹੀ ਵਧੀਆ ਇੱਕ ਅਨੁਭਵ ਹੈ ਜ਼ਿੰਦਗੀ ਦੇ ਵਿੱਚ ਇੱਕ ਬੰਦਾ ਜੇ ਜਦੋਂ ਯਾਤਰਾ ਕਰਦਾ ਵਾ ਉਹ ਵੱਖ ਵੱਖ ਚੀਜ਼ਾਂ ਜ਼ਿੰਦਗੀ ਦੇ ਵਿੱਚੋਂ ਉਹ ਸਿੱਖਦਾ ਵਾ ਜਿੱਦਾਂ ਉਹ ਕਿਤੇ ਜਾਂਦਾ ਵਾ ਉੱਥੇ ਜਾ ਕੇ ਕੁਛ ਨਾ ਕੁਛ ਸਿਖੇਗਾ ਉਹ ਆਪਣੀ ਜ਼ਿੰਦਗੀ ਵਿੱਚ ਕੁਛ ਐਕਸਪਲੋਰ ਕਰੇਗਾ ਇਹ ਐਕਸਪਲੋਰ ਕਰਨ ਦੇ ਨਾਲ ਫਿਰ ਬੰਦਾ ਉਹ ਜ਼ਿੰਦਗੀ ਦੇ ਵਿੱਚ ਫਿਰ ਬੰਦਾ ਅੱਗੇ ਵੱਧਦਾ ਆ ਮੇਰੇ ਹਿਸਾਬ ਨਾਲ ਸਾਰੇ ਜਣਿਆਂ ਨੂੰ ਸਾਨੂੰ ਯਾਤਰਾ ਕਰਨੀ ਚਾਹੀਦੀ ਹੈ ਜੇ ਯਾਤਰਾ ਕਰਨ ਦੇ ਨਾਲ ਸਾਡੇ ਨੌਲੇਜ ਦੇ ਵਿੱਚ ਵਾਧਾ ਹੁੰਦਾ ਵਾ ਜਿੱਥੇ ਜਾਵਾਂਗੇ ਉੱਥੇ ਕੁਛ ਨਾ ਕੁਛ ਅਸੀਂ ਸਿੱਖਾਂਗੇ ਤਾਂ ਉੱਥੇ ਦੇ ਲੋਕਾਂ ਤੋਂ ਉੱਥੋਂ ਦੇ ਕਲਚਰ ਤੋਂ ਉੱਥੋਂ ਦੀ ਨੌਲੇਜ ਅਕਵਾਇਰ ਕਰਾਂਗੇ ਉੱਥੋਂ ਦਾ ਕੀ ਉੱਥੇ ਦਾ ਚਲਦਾ ਪਿਆ ਪਹਿਰਾਵਾ ਕੀ ਚੱਲਦਾ ਪਿਆ ਵਾ ਲੋਕ ਗੀਤ ਕੀ ਚਲਦੇ ਪਏ ਆ ਲੋਕ ਨਾਚ ਉੱਥੋਂ ਦੀ ਲੈਂਗੁਏਜ ਹਰ ਇੱਕ ਚੀਜ਼ ਸਾਨੂੰ ਜਿਹੜੀ ਆ ਉਹ ਇਫੈਕਟ ਕਰਦੀ ਆ ਸਾਨੂੰ ਸਾਰੀਆਂ ਚੀਜ਼ਾਂ ਦਾ ਸਿੱਖਣੀਆਂ ਚਾਹੀਦੀਆਂ ਵਾ ਕਿਉਂਕਿ ਅਸੀਂ ਜ਼ਿੰਦਗੀ ਵਿੱਚ ਆਏ ਹਾਂ ਤਾਂ ਸਾਨੂੰ ਜ਼ਿੰਦਗੀ ਵਿੱਚ ਵੱਖ ਵੱਖ ਥਾਵਾਂ 'ਤੇ ਜਾ ਕੇ ਇਹ ਚੀਜ਼ਾਂ ਦਾ ਐਕਸਪੀਰੀਅੰਸ ਕਰਨਾ ਚਾਹੀਦਾ ਤਜਰਬਾ ਕਰਨਾ ਚਾਹੀਦਾ ਵਾ ਅਤੇ ਮੇਰੇ ਹਿਸਾਬ ਨਾਲ ਜਿਹੜਾ ਵਾ ਇਹ ਸਿੱਖਣ ਦਾ ਜਿਹੜਾ ਤਜਰਬਾ ਜਿਹੜਾ ਵਾ ਸਾਨੂੰ ਜ਼ਿੰਦਗੀ ਭਰ ਚਲਦੇ ਰਹਿਣਾ ਚਾਹੀਦਾ ਅਤੇ ਅਸੀਂ ਸਿੱਖ ਤਾਹੀਓ ਸਕਦੇ ਹਾਂ ਜੇਕਰ ਅਸੀਂ ਕਿਸੇ ਆਪਣੇ ਪੋਜ਼ਟਿਵ ਮਾਇੰਡਸੈਟ ਦੇ ਨਾਲ ਕਿਤੇ ਜਦੋਂ ਕਿਤੇ ਯਾਤਰਾ 'ਤੇ ਜਾਂਦੇ ਹਾਂ ਅਤੇ ਉੱਥੇ ਜਾ ਕੇ ਅਤੇ ਕੁਛ ਨਾ ਕੁਛ ਸਿੱਖਾਂਗੇ ਕੁਛ ਵੇਖਾਂਗੇ ਕੁਛ ਸਿੱਖਾਂਗੇ ਅਤੇ ਕੁਛ ਉੱਥੋਂ ਦੇ ਲੋਕਾਂ ਨੂੰ ਕੁਛ ਆਪਣੇ ਵਿਚਾਰ ਸਾਂਝੇ ਕਰਾਂਗੇ ਉਹਨਾਂ ਦੇ ਨਾਲ